ਹੈਲੋ ਹਾਂਜੀ ਨਮਸਤੇ ਸਰ ਮੈਂ ਹੁਸ਼ਿਆਰਪੁਰ ਤੋਂ ਬੋਲਦੀ ਹਾਂ ਅਤੇ ਤੁਸੀਂ ਮੈਨੂੰ ਹੁਸ਼ਿਆਰਪੁਰ ਦੇ ਜ਼ਿਲ੍ਹੇ ਬਾਰੇ ਹਾਂਜੀ ਰਿਪੋਟਰ ਬੋਲਦੀ ਜੀ ਹੁਸ਼ਿਆਰਪੁਰ ਵਿੱਚ ਹਾਂਜੀ ਹਾਂਜੀ ਅਤੇ ਮੈਂ ਤੁਹਾਨੂੰ ਹੁਸ਼ਿਆਰਪੁਰ ਦੇ ਸੜਕਾਂ ਬਾਰੇ ਬਿਜਲੀ ਬਾਰੇ ਅਤੇ ਪਾਣੀ ਬਾਰੇ ਕੁਛ ਹੈਗਾ ਪੁੱਛਣਾ ਚਾਹੁੰਦੀ ਤੁਹਾਨੂੰ ਵੀ ਕਿੱਦਾਂ ਦਾ ਪ੍ਰਬੰਧ ਹੈ ਇੱਥੇ ਹਾਂਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਹਾਂਜੀ ਹਾਂਜੀ ਉਹ ਤਾਂ ਫੇਰ ਯੂਨਟਾਂ ਦੇ ਹਿਸਾਬ ਨਾਲ ਆਉਂਦੀ ਜਿੰਨੀ ਬਿਜਲੀ ਅਸੀਂ ਯੂਜ਼ ਕਰਾਂਗੇ ਉਨਾ ਹੀ ਫੇਰ ਬਿੱਲ ਆਵੇਗਾ ਉਹ ਤਾਂ ਅੱਛਾ ਜੀ ਠੀਕ ਆ ਅਤੇ ਸੜਕਾਂ ਦੇ ਬਾਰੇ ਕੀ ਤੁਸੀਂ ਦੱਸਣਾ ਚਾਹੁੰਦੇ ਅੱਛਾ ਜੀ ਹਮ ਅੱਛਾ ਜੀ ਹਮ ਬਸ ਸਰ ਹੁਣ ਤਾਂ ਹੁਣ ਤਾਂ ਮੇਰੇ ਦੇਖਣ 'ਚ ਸਹੀ ਆ ਸਾਰੀਆਂ ਸੜਕਾਂ ਵੀ ਵਧੀਆ ਵਾ ਪਾਣੀ ਦੇ ਪ੍ਰਬੰਧ ਵੀ ਵਧੀਆ ਵਾ ਹਾਂਜੀ ਅੱਛਾ ਜੀ ਅਤੇ ਇੱਕ ਹੋਰ ਘੰਟੇ ਦੇ ਸਰਕਾਰ ਹੌਲੀ ਹੌਲੀ ਕਦੋਂ ਨਾ ਹੌਲੀ ਹੌਲੀ ਜਿੱਦਾਂ ਸਰਕਾਰ ਦੀ ਗਰਾਂਟ ਆਉਂਦੀ ਆ ਫੇਰ ਹੌਲੀ ਹੌਲੀ ਸਾਰੇ ਸਹੀ ਕੰਮ ਹੁੰਦੇ ਆ ਹਾਂਜੀ ਠੀਕ ਆ

ਬਿਜਲੀ ਦੇ ਜ਼ਿਆਦਾ ਬਿਜਲੀ ਦੇ ਜ਼ਿਆਦਾ ਕੱਟ ਤਾਂ ਨਹੀਂ ਲੱਗਦੇ ਹਾਂਜੀ ਉਹ ਤਾਂ ਵੈਸੇ ਵੀ ਜ ਗਰਮੀ ਦੇ ਵਿੱਚ ਜ਼ਿਆਦਾ ਫਿਰ ਜਦੋਂ ਖਰਾਬ ਹੋ ਜਾਂਦੀ ਫਿਰ ਛੇਤੀ ਸਰਕਾਰ ਠੀਕ ਵੀ ਕਰ ਦਿੰਦੀ ਆ ਹਾਂਜੀ ਹਾਂਜੀ ਉਹ ਤਾਂ ਫਿਰ ਕੰਪਲੇਂਟ ਕਰਦੇ ਫਿਰ ਸਰਕਾਰ ਕਰਦੀ ਹੈ ਫਿਰ ਮਤਲਬ ਕੀ ਕਰਦੇ ਆ ਕੰਪਲੇਂਟ ਉਸ ਕੰਪਲੇਂਟ 'ਤੇ ਦੇਖ ਕੇ ਅਤੇ ਸਰ ਜਿਹੜੇ ਕਰਮਚਾਰੀ ਆ ਉਹ ਅੱਗੇ ਇੱਕ ਕੁਛ ਕਰਦੇ ਆ ਆਪਣਾ ਕੰਮ ਬਾਕੀ ਸਰਕਾਰ ਹੌਲੀ ਹੌਲੀ ਜਦੋਂ ਗਰਾਂਟ ਆਵੇਗੀ ਫਿਰ ਹੌਲੀ ਹੌਲੀ ਸਾਰਾ ਕੰਮ ਹੋਵੇਗਾ ਬਸ ਠੀਕ ਆ ਓਕੇ ਜੀ